ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ ਜਿਸ ਦੇ ਵਿੱਚ ਵਪਾਰ ਤੋਂ ਲੈ ਕੇ ਬੈਂਕਿੰਗ ਤੱਕ ਇਨਸਾਨ ਦੇ ਲਈ ਇੰਟਰਨੈੱਟ ਨੇ ਬਹੁਤ ਸੁਖਾਲਾ ਕਰ ਦਿੱਤਾ ਹੈ ਜਿਸ ਦੇ ਵਿੱਚ ਕਿਸੇ ਨੇ ਕੋਈ ਸਮਾਨ ਖਰੀਦਣਾ ਹੁੰਦਾ ਜਾਂ ਵੇਚਣਾ ਹੁੰਦਾ ਹੈ ਉਹ ਇੰਟਰਨੈੱਟ ਦੇ ਜ਼ਰੀਏ ਹੀ ਉਹ ਖਰੀਦਦਾ ਜਾਂ ਵੇਚਦਾ ਹੈ ਇਸਦਾ ਇੱਕ ਫਾਇਦਾ ਇਹ ਹੁੰਦਾ ਹੈ ਕਿ ਕੋਈ ਵੀ ਬੰਦਾ ਜੇ ਕੋਈ ਸਮਾਨ ਖਰੀਦਦਾ ਉਹ ਔਨਲਾਈਨ ਚੈੱਕ ਕਰਕੇ ਔਡਰ ਕਰਦਾ ਹੈ ਅਤੇ ਕਿਤੇ ਵੀ ਬੈਠਾ ਹੋਵੇ ਉਸਦਾ ਔਡਰ ਉਸ ਤੱਕ ਪਹੁੰਚ ਜਾਂਦਾ ਹੈ ਅਤੇ ਉਹ ਗੂਗਲ ਪੇਅ ਪੇਟੀਐੱਮ ਜਾਂ ਫ਼ੋਨ ਪੇਅ ਰਾਹੀਂ ਪੇਮੈਂਟ ਕਰ ਦਿੰਦਾ ਹੈ ਇਸ ਦੇ ਨਾਲ਼ ਬੰਦੇ ਦਾ ਬਹੁਤ ਸਾਰਾ ਸਮਾਂ ਬਚ ਜਾਂਦਾ ਹੈ ਅਤੇ ਹਰਾਸ਼ ਹੋਣ ਤੋਂ ਬੱਚਦਾ ਹੈ ਜੀ ਉਹ ਉਸ ਤੋਂ ਬਾਅਦ ਜੇ ਗੱਲ ਕਰੀਏ ਇੰਟਰਨੈੱਟ ਦੀ ਤਾਂ ਅਸੀਂ ਕਿਤੇ ਵੀ ਬੈਠੇ ਹੁੰਦੇ ਹਾਂ ਬਿਜਲੀ ਦਾ ਬਿੱਲ ਹੈ ਪਾਣੀ ਦਾ ਬਿੱਲ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਿੱਲ ਹੈ ਅਸੀਂ ਲੰਬੀਆਂ ਲੰਬੀਆਂ ਲਾਈਨਾਂ ਲਾਉਂਦੇ ਸੀ ਪਹਿਲਾਂ ਹੁਣ ਅੱਜ ਇੰਟਰਨੈੱਟ ਦੇ ਯੁੱਗ ਦੇ ਵਿੱਚ ਅਸੀਂ ਘਰ ਬੈਠੇ ਬੈਠੇ ਉਹ ਬਿਲ ਔਨਲਾਈਨ ਭਰ ਸਕਦੇ ਹਾਂ ਜਿਹਦੇ ਨਾਲ਼ ਬਹੁਤ ਸਾਰਾ ਸਮਾਂ ਬੱਚ ਜਾਂਦਾ ਅਤੇ ਬੰਦੇ ਨੂੰ ਬਹੁਤ ਸੁਖਾਲਾ ਇੰਟਰਨੈੱਟ ਨੇ ਕਰ ਦਿੱਤਾ ਹੈ